ਜਸਪ੍ਰੀਤ ਕੌਰ ਹਰਦੀਪ ਮਨਜੀਤ ਸਿੰਘ ਰਾਮ ਲਾਲ ਹਰਵਿੰਦਰ ਕੌਰ ਮੋਨੀਕਾ ਇੰਦਰਜੀਤ ਕੌਰ ਬਲਜਿੰਦਰ ਕੌਰ ਅਮਨਦੀਪ ਕੌਰ ਸੀਆ ਅੰਜੂ ਅਮਨ ਜਸ